ਮੈਂ ਤੁਹਾਡੇ ਨਾਲ ਆਪਣੀ ਯੋਗਾ ਕਲਾਸ ਦਾ ਅਨੁਭਵ ਵਰਨਣ ਕਰਨਾ ਚਾਹੁੰਦਾ ਹਾਂ ਜਦੋਂ ਮੇਰਾ ਪਹਿਲਾ ਦਿਨ ਸੀ ਆਪਣੇ ਯੋਗਾ ਕਲਾਸ ਵਿੱਚ ਉਦੋਂ ਮੈਨੂੰ ਥੋੜ੍ਹੀ ਜਿਹੀ ਹਿਚਕਿਚਾਹਟ ਸੀ ਕਿਉਂਕਿ ਮੈਨੂੰ ਇਹ ਦਿੱਕਤ ਹੋ ਰਹੀ ਸੀ ਕਿ ਮੈਂ ਬਾਕੀਆਂ ਵਰਗਾ ਵਧੀਆ ਯੋਗਾ ਸਹੀ ਪੋਜ਼ ਵਿੱਚ ਕਰ ਪਾਵਾਂਗਾ ਕਿ ਨਹੀਂ ਜਿਸ ਕਰਕੇ ਮੈਨੂੰ ਥੋੜ੍ਹੀ ਜਿਹੀ ਹਿਚਕਿਚਾਹਟ ਸੀ ਪਰ ਜਦੋਂ ਮੈਂ ਆਰਾਮ ਨਾਲ ਗ ਆਪਣੇ ਟੀਚਰ ਵੱਲ ਵੇਖ ਵੇਖ ਕੇ ਯੋਗਾ ਕਰਨਾ ਸ਼ੁਰੂ ਕੀਤਾ ਤਾਂ ਫਿਰ ਮੇਰੇ ਵਿੱਚ ਥੋੜ੍ਹਾ ਜਿਹਾ ਕੋਨਫੀਡੈਂਸ ਆਇਆ ਕਿ ਮੈਂ ਵੀ ਯੋਗਾ ਕਰ ਸਕਦਾ ਹਾਂ ਅਤੇ ਆਪਣੇ ਸਰੀਰ ਨੂੰ ਤੰਦਰੁਸਤ ਰੱਖ ਸਕਦਾ ਹਾਂ ਜਦੋਂ ਮੈਂ ਆਰਾਮ ਨਾਲ ਆਪਣੇ ਯੋਗਾ ਪੋਜ ਬਣਾਉਣਾ ਸ਼ੁਰੂ ਕੀਤੇ ਤਾਂ ਫਿਰ ਮੈਨੂੰ ਥੋੜ੍ਹਾ ਅੱਛਾ ਲੱਗਣ ਲੱਗ ਪਿਆ ਫਿਰ ਮੈਂ ਆਪਣੇ ਨਾਲ ਬੈਠੇ ਸਹਿਪਾਠੀਆਂ ਮਿੱਤਰ ਮਤਲਬ ਮਿੱਤਰ ਨਾਲ ਆਪਣੀ ਗੱਲ ਵਗੈਰਾ ਕੀਤੀ ਜਿਸ ਕਰਕੇ ਮੈਨੂੰ ਥੋੜ੍ਹਾ ਹੋਰ ਅੱਛਾ ਲੱਗਿਆ ਅਤੇ ਹੁਣ ਮੈਂ ਜਦੋਂ ਰੋਜ਼ ਜਾਨਾ ਹਾਂ ਤਾਂ ਮੈਨੂੰ ਕੋਈ ਦਿੱਕਤ ਨਹੀਂ ਹੁੰਦੀ ਕਿਉਂਕਿ ਹੁਣ ਮੈਨੂੰ ਯੋਗਾ ਅੱਛੀ ਤਰ੍ਹਾਂ ਕਰਨਾ ਆਉਂਦਾ ਹੈ ਅਤੇ ਹੁਣ ਮੇਰੇ ਬਹੁਤ ਸਾਰੇ ਲੋਕ ਉੱਥੇ ਵਾਕਫ ਵੀ ਹੋ ਗਏ ਹਨ ਜਿਹਨਾਂ ਨਾਲ ਮੈਂ ਆਪਣੀ ਕੋਈ ਗੱਲਬਾਤ ਕਰ ਸਕਦਾ ਹਾਂ ਇਸ ਕਰਕੇ ਸਾਨੂੰ ਕਦੀ ਵੀ ਕੋਈ ਵੀ ਨਵੀਂ ਚੀਜ਼ ਕਰਨ ਤੋਂ ਪਹਿਲੇ ਸੰਗਣਾ ਨਹੀਂ ਚਾਹੀਦਾ ਕਿਉਂਕਿ ਯੋਗਾ ਇੱਕ ਐਸੀ ਚੀਜ਼ ਹੈ ਜੋ ਕਿ ਸਾਡੇ ਸਰੀਰ ਨੂੰ ਮਾਨਸਿਕ ਅਤੇ ਸਰੀਰਕ ਰੂਪ ਵਿੱਚ ਬਹੁਤ ਜ਼ਿਆਦਾ ਲਾਭਦਾਇਕ ਹੁੰਦਾ ਹੈ ਇਸ ਕਰਕੇ ਸਾਨੂੰ ਆਪਣੇ ਯੋਗਾ ਕਰਨਾ ਚਾਹੀਦਾ ਹੈ